ਹੈਲੋ ਹਾਂਜੀ ਸਰਦਾਰ ਕਰਮ ਕਰਮਵੀਰ ਸਿੰਘ ਬੋਲਦੇ ਜੇ ਮੈਂ ਜਗਜੀਤ ਸਿੰਘ ਬੋਲਦਾ ਘਸੀਟਪੁਰ ਤੋਂ ਹਾਂਜੀ ਉਹ ਉਹ ਵਧੀਆ ਵਧੀਆ ਜੀ ਮੈਂ ਕਿਹਾ ਉਹ ਹਾਂਜੀ ਵਧੀਆ ਚੜ੍ਹਦੀ ਕਲਾ ਠੀਕ ਠਾਕ ਤੁਸੀਂ ਸੁਣਾਓ ਵਾ ਵਧੀਆ ਠੀਕ ਜੀ ਕੰਮ ਕੰਮ ਤੁਸੀਂ ਥੋੜ੍ਹਾ ਜਿਹਾ ਨਾ ਐਤਕਾਂ ਖ਼ਰਾਬ ਹੀ ਕਰਕੇ ਗਏ ਜੇ ਅਤੇ ਜਿਹੜਾ ਗੋਡੀ ਗਾਡੀ ਵਾਲਾ ਸਿਸਟਮ ਜਿਹੜੀ ਲੇਬਰ ਦਾ ਹੈ ਜੇ ਨਾਲ ਅੱਜ ਨਾ ਅਰਕਾ ਗੋਡੀ ਨਹੀਂ ਚੰਗੀ ਕੀਤੀ ਨਾਲ ਪਰ ਜਿਹੜੇ ਬਦਲੇ ਵੀ ਆ ਅਤੇ ਥੋੜ੍ਹਾ ਜਿਹੀ ਵੱਲਾ ਬੱਲਾ ਵੀ ਇੱਧਰ ਉੱਧਰ ਚੁੱਕ ਚੁੱਕ ਮਾਰੀਆਂ ਵਾ ਨਹੀਂ ਤਾਂ ਅੱਗੇ ਵੀ ਗੋਡੀ ਕਰਾਈ ਦੀ ਤੇ ਉਹ ਨਹੀਂ ਕੋਈ ਹਿਲ ਜੁਲ ਹੁੰਦੀ ਅਤੇ ਅਰਕਾ ਥੋੜ੍ਹਾ ਜਿਹਾ ਪਰ ਐਤਕਾਂ ਥੋੜ੍ਹਾ ਜਿਹਾ ਸਿਸਟਮ ਥੋੜ੍ਹਾ ਨਹੀਂ ਜ਼ਿਆਦਾ ਹੀ ਖ਼ਰਾਬ ਕੀਤਾ ਜੇ ਅਤੇ ਕੰਮ ਨਹੀਂ ਅਰਕਾ ਸਹੀ ਕੀਤਾ ਕੰਮ ਤਾਂ ਫਿਰ ਅਗਾਂਹ ਤਾਂ ਹੀ ਦੇਵਾਂਗੇ ਜੇ ਅਰਕਾ ਮਤਲਬ ਬੰਦਾ ਕੰਮ ਵਧੀਆ ਕਰਕੇ ਜਾਵੇ ਪਰ ਐਤਕਾਂ ਉਲਾਂਭੇ ਵਾਲੀ ਗੱਲ ਸੀ ਤਾਂ ਉਲਾਂਭਾ ਦੇਡਿਆ ਜੇ ਨਾ ਉਲਾਂਭੇ ਵਾਲੀ ਗੱਲ ਹੁੰਦੀ ਤਾਂ ਫਿਰ ਤੁਹਾਨੂੰ ਪਤਾ ਹੀ ਆ ਉਲਾਂਭਾ ਦੇਣ ਨੂੰ ਜੀਅ ਕਰਦਾ ਵਾ ਨਹੀਂ ਦੋਵਾਂ 'ਚੋਂ ਦੋਵਾਂ 'ਚੋਂ ਹੀ ਇਹਨੇ ਵੀ ਇੱਕ 'ਚੋਂ ਤੁਸੀਂ ਘੰਟਾ ਗਏ ਹੋਓਂਗੇ ਅਤੇ ਘੰਟੇ ਦੇ ਵਿੱਚ ਤਾਂ ਜਿੰਨਾ ਕੁ ਥਾਂ ਗੁੱਡਿਆ ਉਨੀ ਖ਼ਰਾਬੀ ਆਉਣੀ ਵੀ ਤਾਂ ਕਰਕੇ ਸਾਰੀ ਸਾਰੀ ਪੈਲੀ ਦੇ ਵਿੱਚ ਹੀ ਖ਼ਰਾਬੀ ਆਈ ਆ ਹਾਂਜੀ ਹਾਂ ਨਹੀਂ ਪਰ ਤੁਹਾਨੂੰ ਤੁਹਾਨੂੰ ਚਾਹੀਦਾ ਹੀ ਵੀ ਨਾਲ ਹੀ ਲੱਗ ਕੇ ਅਤੇ ਫਿਰ ਵੇਖ ਕੇ ਆਪਣੇ ਧਿਆਨ ਨਿਗਰਾਨੀ ਹੇਠ ਕੰਮ ਕਰਾਉਂਦੇ ਤਾਂ ਫਿਰ ਭਾਵੇਂ ਸਹੀ ਹੁੰਦਾ ਅਤੇ ਹਾਂਜੀ ਠੀਕ ਆ

ਕਮਾਦ ਦੀ ਗੋਡੀ ਥੋੜ੍ਹੀ ਜਿਹੀ ਹੋਰ ਹਿਸਾਬ ਦੀ ਤੁਹਾਨੂੰ ਪਤਾ ਸਬਜ਼ੀ ਦੀ ਗੋਡੀ ਹੋਰ ਹਿਸਾਬ ਦੀ ਆ ਹਾਂ ਅਤੇ ਸਫਾਈ ਵੀ ਉਨੀ ਵਧੀਆ ਨਹੀਂ ਆਈ ਅਰਕਾ ਕੰਮ ਦੀ ਅਤੇ ਕੰਮ ਵੀ ਠੀਕ ਨਹੀਂ ਹੋਇਆ ਜੇ ਨਹੀਂ ਨਹੀਂ ਢੇਰੀਆਂ ਲਾ ਕੇ ਵਿੱਚ ਹੀ ਰਹਿਣ ਦਿੱਤੀਆਂ ਜੇ ਉਹ ਤਾਂ ਹੁਣ ਆਪ ਬੰਦਾ ਡਾ ਕੇ ਤਾਂ ਫਿਰ ਕਢਾਈਆਂ ਵਾ ਨਹੀਂ ਪਰ ਇੱਦਾਂ ਮੁਸ਼ਕਿਲ ਹੁੰਦੀ ਆ ਨਾ ਨਹੀਂ ਖ਼ਰਾਬ ਕੀਤਾ ਅਰਕਾ ਕੰਮ ਫਿਰ ਅਗਾਂਹ ਵਾਸਤੇ ਮੁਸ਼ਕਿਲ ਹੁੰਦੀ ਹੈ ਨਾ ਕੰਮ ਦੇਣ ਨੂੰ ਤਾਂ ਹੀ ਜੀਅ ਕਰਦਾ ਜੇ ਕੰਮ ਵਧੀਆ ਹੋਇਆ ਹੋਵੇ ਠੀਕ ਆ ਚਲੋ ਅਗਾਂਹ ਵਾਸਤੇ ਨਾ ਆਪਣੀ ਨਿਗਰਾਨੀ ਹੇਠ ਲੈ ਕੇ ਫਿਰ ਕੰਮ ਕਰਾਇਆ ਕਰੋ ਜ਼ਿੰਮੇਵਾਰੀ ਤੁਹਾਨੂੰ ਦਿੱਤੀ ਜਦੋਂ ਕੰਮ ਤੁਹਾਨੂੰ ਕਹੀ ਦਾ ਫਿਰ ਜ਼ਿੰਮੇਵਾਰੀ ਵੀ ਤੁਹਾਡੀ ਬਣਦੀ ਵੀ ਕੰਮ ਸਹੀ ਤਰੀਕੇ ਨਾਲ ਕਰੋ ਚਲੋ ਠੀਕ ਆ ਕੋਈ ਗੱਲ ਨਹੀਂ ਜੇ ਪੇਮੈਂਟ ਭਾਵੇਂ ਕੱਲ੍ਹ ਨੂੰ ਆਪ ਆਣ ਕੇ ਲੈ ਜਿਓ ਨਾ ਆਓ ਤਾਂ ਫਿਰ ਪਾ ਦਾਂਗੇ ਜੇ ਕੱਲ੍ਹ ਨੂੰ ਆਪ ਆਣ ਕੇ ਲੈ ਜਿਓ ਜਾਂ ਤੁਹਾਨੂੰ ਪਵਾ ਦਾਂਗੇ ਕੱਲ੍ਹ ਨੂੰ ਕੋਈ ਨਹੀਂ ਆਪ ਆਉਣਾ ਹੋਊਗਾ ਤਾਂ ਵੀ ਠੀਕ ਆ ਨਹੀ ਤਾਂ ਔਨਲਾਈਨ ਪਾ ਦਾਂਗੇ ਕੋ ਦੱਸ ਦਿਓ ਜਿੱਦਾਂ ਕਰਨੀ ਹੋਊ ਚਲੋ ਠੀਕ ਆ ਜੀ ਠੀਕ